ਮੇਰਾ ਮਨਪਸੰਦ ਮੌਸਮ ਠੰਢ ਹੈ ਠੰਢ ਵਿੱਚ ਪਸੀਨਾ ਘੱਟ ਆਉਂਦਾ ਹੈ ਅਤੇ ਹਮੇਸ਼ਾ ਤੰਦਰੁਸਤ ਅਤੇ ਤਾਜ਼ਾ ਫੀਲ ਕਰਦੇ ਹਾਂ ਠੰਢ ਵਿੱਚ ਮੈਨੂੰ ਨਵੀਆਂ ਚੀਜ਼ਾਂ ਖਾਣ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਿਵੇਂ ਕਿ ਮੂੰਗਫਲੀ ਪਰ ਠੰਢ ਵਿੱਚ ਮੈਨੂੰ ਜ਼ਿਆਦਾਤਰ ਆਇਸ ਕਰੀਮ ਖਾਣ ਦਾ ਮਜ਼ਾ ਆਉਂਦਾ ਹੈ ਗਰਮੀਆਂ ਨਾਲੋਂ ਅਤੇ ਠੰਢ ਵਿੱਚ ਮੈਂ ਬਹੁਤ ਸਾਰੇ ਤਿਉਹਾਰ ਆਉਂਦੇ ਹਨ ਜਿਹੜੇ ਕਿ ਮੈਂ ਬੜੀ ਧੂਮ ਧਾਮ ਨਾਲ ਮਨਾਉਂਦੀ ਹਾਂ ਜਿਵੇਂ ਕਿ ਲੋਹੜੀ ਦਿਵਾਲੀ ਇਹ ਸਾਰੇ ਅਤੇ ਮੈਨੂੰ ਠੰਢ ਵਿੱਚ ਕਾਲੇ ਕੱਪੜੇ ਪਾਉਣਾ ਬੜੇ ਪਸੰਦ ਹਨ ਅ ਕਿਉਂਕਿ ਗਰਮੀਆਂ ਵਿੱਚ ਕਾਲੇ ਕੱਪੜੇ ਪਾਉਣ ਨਾਲ ਜ਼ਿਆਦਾ ਗਰਮੀ ਲੱਗਦੀ ਆ ਪਰ ਠੰਢ ਵਿੱਚ ਇਹ ਕੱਪੜੇ ਮੈਂ ਆਰਾਮ ਨਾਲ ਪਾ ਸਕਦੀ ਹਾਂ ਅਤੇ ਠੰਢ ਵਿੱਚ ਮੈਨੂੰ ਲੌਂਗ ਕੋਟ ਕੌਫ਼ੀ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਲੱਗਦੀਆਂ ਹਨ ਜਿਸ ਨਾਲ ਕਿ ਮੈਨੂੰ ਠੰਢ ਦਾ ਮੌਸਮ ਸਾਰਿਆਂ ਨਾਲੋਂ ਵਧੀਆ ਲੱਗਦਾ ਹੈ